ਹੈਲੋ ਮੈਂ ਨਾ ਮੈਂ ਨਾ ਨਵੀਆਂ ਕਿਤਾਬਾਂ ਲੈਣੀਆਂ ਨੇ ਸੈਕਿੰਡਹੈਂਡ ਬੀ ਏ ਸੈਕਿੰਡ ਸਮੈਸਟਰ ਦੀ ਅਤੇ ਫਸਟ ਸਮੈਸਟਰ ਦੀ ਮੈਂ ਦੇਣੀ ਆ ਅਤੇ ਅਤੇ ਫਸਟ ਸਮੈਸਟਰ ਦੀ ਮੈਂ ਹਿਸਟਰੀ ਜੋਗਰਫੀ ਅਤੇ ਫਿਜ਼ੀਕਲ ਦੇਣੀ ਹੈ ਅਤੇ ਸੈਕਿੰਡ ਸਮੈਸਟਰ ਦੀ ਮੈਂ ਨਾ ਫਿਜ਼ੀਕਲ ਨਹੀਂ ਲੈਣੀ ਦੂਜੀ ਬੁੱਕ ਲੈਣੀ ਹੈ ਜੇ ਹਿਸਟਰੀ ਦੀ ਮੈਂ ਵੈਸੇ ਹੀ ਪੇਂਡੂ ਹਾਂ ਕਿ ਤੁਸੀਂ ਮੈਨੂੰ ਦਸ ਪਰਸੈਂਟ ਦੀ ਓ ਕਰੋਗੇ ਪਲੀਜ਼ ਦੇ ਦਿਓ ਨਾ ਅਤੇ ਕਿਤਾਬ ਨਵੀਂ ਆਡੀਸ਼ਨ ਦੀ ਹੋਵੋਗੀ ਚੰਗਾ ਉਹ ਚੰਗਾ ਉਹ ਤਾਂ ਗੱਲ ਠੀਕ ਹੈ ਪਰ ਸਿਲੇਬਸ ਚੇਂਜ ਹੋਇਆ ਤਾਂ ਮੈਨੂੰ ਪੁਰਾਣੀ ਬੂਕ ਤਾਂ ਨਹੀਂ ਦੇ ਦਿਓਗੇ ਤੁਸੀਂ ਠੀਕ ਹੈ ਅਤੇ ਜੋਗ੍ਰਫ਼ੀ ਦੀ ਬੁੱਕ ਕਿਹੜੇ ਸਮੈਸਟਰ ਦੀ ਮਤਲਬ ਕਿ ਕਿੰਨੇ ਕੁ ਪਰੈਸ 'ਚ ਮਿਲੇਗੀ ਮੈਨੂੰ ਫੋਰਟੀ ਪਰਸੈਂਟ 'ਤੇ ਜਾਂ ਫੋਰਟੀ ਫਾਈਵ ਪਰਸੈਂਟ 'ਤੇ ਮਿਲ ਜਾਵੇਗੀ ਪਹਿਲਾਂ ਵੇਖ ਲਓ ਤੁਸੀਂ ਮੈਂ ਵੈਸੇ ਵਾਧੂ ਕਿਤਾਬਾਂ ਲੈਣੀਆ ਨੇ ਅੱਛਾ ਫਿਰ ਮੈਂ ਥਰਡ ਸਮੈਸਟਰ ਦੀ ਲੇਵਾਂ ਤਾਂ ਉਹ ਵੀ ਇੰਨੇ 'ਚ ਮਿਲੇਗੀ ਮੈਨੂੰ ਚਲੋ ਠੀਕ ਹੈ ਮੈਂ ਫਿਰ ਕਾਲ ਕਰ ਲਵਾਂਗੀ ਤੁਹਾਨੂੰ ਜਦੋਂ ਲੈਣੀ ਹੋਵੇਗੀ ਮੈਂ ਚੰਗਾ ਚੰਗਾ ਉਹ ਤਾਂ ਫਿਰ ਚਲੋ ਠੀਕ ਆ ਪਰ ਵੇਖ ਲਿਆ ਜੇ ਚਲੋ ਠੀਕ ਹੈ